ਹੱਥ ਨਾਲ ਬਣੇ ਕੱਪੜੇ ਸ਼ ਮਸ਼ੀਨਾਂ ਨਾਲ ਬਣੇ ਕੱਪੜੇ ਦੇ ਨਾਲੋ ਅਲੱਗ ਹੁੰਦੇ ਹਨ ਇਸ ਤੱਥ ਦਾ ਇੱਕ ਦਾ ਕੇ ਹਰ ਇੱਕ ਕੱਪੜਾ ਹੱਥ ਨਾਲ ਬਣਾਇਆ ਗਿਆ ਹੈ ਇਹਦਾ ਮਤਲਬ ਹੈ ਕਿ ਮੈਂ ਘੱਟ ਮਾਤਰਾ ਵਿੱਚ ਪੈਦਾ ਕਰਦਾ ਹਾਂ ਜਿਵੇਂ ਕਿ ਜ਼ਿਆਦਾਤਰ ਛੋਟੇ ਨਿਰਮਾਤਾ ਹਰ ਆਈਟਮ ਸੀਮਿਤ ਅਤੇ ਵਿਸ਼ੇਸ਼ ਹੈ ਅਸੈਂਬਲੀ ਲਾਇਨ ਵਿੱਚ ਕੁਝ ਡਿਜਾਇਨ ਬਣਾਉਣੇ ਬਹੁਤ ਔਖੇ ਹੁੰਦੇ ਹਨ ਇਸ ਲਈ ਹਰ ਆਈਟਮ ਨੂੰ ਹੱਥੀ ਬਣਾ ਕੇ ਉਸ ਨੂੰ ਬਹੁਤ ਹੀ ਵਿਲੱਖਣ ਡਿਜਾਈਨ ਬਣਾ ਸਕਦੇ ਆ ਹੈਂਡਮੇਡ ਕੱਪੜਾ ਅਤੇ ਸਟਾਈਲ ਨੂੰ ਅਨੁਕੂਲਿਤ ਕਰਨਾ ਆਸਾਨ ਬਣਾਉਂਦਾ ਹੈ ਇਸਦੀ ਫਿਟਿੰਗ ਬਹੁਤ ਹੀ ਵਧੀਆ ਹੁੰਦੀ ਹੈ ਸ਼ੈਲੀ ਦੇ ਵੇਰਵਿਆਂ ਨੂੰ ਬਦਲ ਸਕਦਾ ਹਾਂ ਕਿਉਂਕਿ ਹਰੇਕ ਕੱਪੜੇ ਨੂੰ ਵਿਅਕਤੀਗਤ ਤੌਰ 'ਤੇ ਸਿਰਫ ਗਾਹਕ ਲਈ ਬਣਾਇਆ ਗਿਆ ਹੈ ਖਾਸ ਕਰਕੇ ਜੇਕਰ ਤੁਸੀਂ ਹਰ ਆਈਟਮ ਨੂੰ ਆਰਡਰ ਕਰਨ ਲਈ ਬਣਾ ਰਹੇ ਹੋ ਨਿਰਮਾਣ ਕਰਦੇ ਸਮੇਂ ਤੁਸੀਂ ਸਿੰਗਲ ਕੱਪੜਿਆਂ ਲਈ ਐਡਜਸਟਮੈਂਟ ਨਹੀਂ ਕਰ ਸਕਦੇ ਕਿਉਂਕਿ ਉੱਥੇ ਵਰਿਗਾਮਾ ਦਾ ਪਹਿਲਾਂ ਹੀ ਮੌਜੂਦ ਹਨ ਤੁਹਾਡੇ ਗਾਹਕਾਂ ਨੂੰ ਇਹ ਸਮਝਾਉਣਾ ਔਖਾ ਨਹੀਂ ਹੈ ਕਿ ਤੁਹਾਡੇ ਕੱਪੜੇ ਕੌਣ ਅਤੇ ਕਿਵੇਂ ਬਣਾਏ ਜਾ ਰਹੇ ਹਨ ਜਦੋਂ ਸਿਰਫ ਇੱਕ ਵਿਅਕਤੀ ਇਸ ਨੂੰ ਬਣਾ ਰਿਹਾ ਹੈ ਵੱਡੇ ਗਲੋਬਲ ਬ੍ਰਾਂਡਾਂ ਦੇ ਨਾਲ ਜੋ ਨਿਰਮਾਣ ਕਰਦੇ ਹਨ ਗ੍ਰਾਹਕ ਲਈ ਇਹ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੈ ਇਹ ਕੱਪੜੇ ਕਿੱਥੇ ਬਣਾਏ ਜਾ ਰਹੇ ਹਨ ਜੇਕਰ ਕਰਮਚਾਰੀਆਂ ਨੂੰ ਉੱਚਿਤ ਭੁਗਤਾਨ ਕੀਤਾ ਜਾ ਰਿਹਾ ਹੈ ਅਤੇ ਜੇਕਰ ਉਹਨਾਂ ਕੋਲ ਕੋਈ ਕੰਮ ਕਰਨ ਦੀਆਂ ਚੰਗੀਆਂ ਸਥਿਤੀਆਂ ਹਨ ਵਿਲੱਖਣ ਕਿਉਂਕਿ ਹਰੇਕ ਬੁਣੇ ਹੋਏ ਹਿੱਸੇ ਨੂੰ ਵਿਸ਼ੇਸ਼ ਤੌਰ 'ਤੇ ਉੱਚੀ ਪੱਧਰ ਕਾਰੀਗਿਰੀ ਨਾਲ ਤਿਆਰ ਕੀਤਾ ਗਿਆ ਹੈ ਉਹ ਹਮੇਸ਼ਾ ਵਿਲੱਖਣ ਹੁੰਦੇ ਹਨ ਅਕਸਰ ਸ਼ਿਲਪਕਾਰੀ ਨਾਲ ਤਿਆਰ ਕੀਤੇ ਜਾਂਦੇ ਹਨ ਅਨੂਕੂਲਿਤ ਹੱਥ ਨਾਲ ਬਣੇ ਕੱਪੜੇ ਸਤਕ ਨੂੰ ਅਨੁਕੂਲਿਤ ਹੁੰਦੇ ਹਨ ਕਿ ਕੋਈ ਵੀ ਉਸਨੂੰ ਪਸੰਦ ਦੇ ਅਨੁਸਾਰ ਡਿਜ਼ਾਇਨ ਕਰ ਸਕਦਾ ਹੈ ਹੱਥ ਨਾਲ ਬਣੇ ਉਤਪਾਦ ਵੀ ਉੱਚ ਗੁਣਵੱਤਾ ਵਾਲੇ ਹੋਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ ਇਹ ਇਸ ਲਈ ਹੈ ਕਿਉਂਕਿ ਕਾਰੀਗਰ ਕੋਲੋਂ ਉਤਪਾਦ ਨੂੰ ਸੰਪੂਰਨ ਕਰਨ ਲਈ ਵਧੇਰੇ ਸਮਾਂ ਹੁੰਦਾ ਹੈ ਅਤੇ ਉਤਪਾਦ ਦੇ ਜਲਦਬਾਜ਼ੀ ਜਾਂ ਘੱਟ ਗੁਣਵੱਤਾ ਵਾਲੀ ਸਮੱਗਰੀ ਦੀ ਵਰਤੋਂ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ਹੱਥਾਂ ਨਾਲ ਬਣਾਇਆ ਗਿਆ ਕੱਪੜਾ ਹਰ ਵਕਤ ਪਿਆਰ ਅਤੇ ਹੁਨਰ ਦੀ ਰਚਨਾ ਹੈ ਕਾਰੀਗਰ ਇੱਕ ਸੁੰਦਰ ਵਸਤੂ ਬਣਾਉਣ ਲਈ ਆਪਣੀ ਸਾਰੀ ਏ ਬਦਾਮਾ ਦੀ ਵਰਤੋਂ ਕਰਦੇ ਹਨ ਜੋ ਉਹਨਾਂ ਦੀ ਕਾਰੀਗਰੀ ਦਾ ਜਸ਼ਨ ਮਨਾਉਂਦੀ ਹੈ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਰੇਕ ਟੁਕੜੇ ਦੀ ਕਲਪਨਾ ਕੀਤੀ ਹੈ ਇਸ ਕਰਕੇ ਹੱਥ ਨਾਲ ਬਣਿਆ ਕੱਪੜਾ ਲੋਕ ਜ਼ਿਆਦਾ ਪਸੰਦ ਕਰਦੇ ਹਨ ਮਸ਼ੀਨਾਂ ਨਾਲ ਬਣੇ ਕੱਪੜੇ ਦੀ ਬਜਾਏ ਹਰ ਹਰ ਇੱਕ ਬੰਦਾ ਹੱਥ ਨਾਲ ਬਣੇ ਕੱਪੜੇ ਲੈਣ ਲਈ ਕਾਹਲਾ ਰਹਿੰਦਾ ਹੈ